ਘਰ ਦੇ ਵਿੱਚ ਖੁਦ ਫਲ਼ ਅਤੇ ਸਬਜ਼ੀਆਂ ਉਗਾਉਣਾ ਬਹੁਤ ਹੀ ਵਧੀਆ ਗੱਲ ਹੈ ਮੈਂ ਘਰ ਦੇ ਵਿੱਚ ਆਪਣੇ ਜਿਵੇਂ ਕਿ ਅਮਰੂਦ ਸੇਬ ਕੀਨੂੰ ਅੰਬ ਬੇਰ ਆਦਿ ਫਲ ਉਗਾਏ ਹਨ ਸਬਜ਼ੀਆਂ ਦੇ ਵਿੱਚ ਮੈਂ ਕਈ ਤਰ੍ਹਾਂ ਦੀ ਜਿਵੇਂ ਕਿ ਤੋਰੀ ਬੈਂਗਨ ਘੀਆ ਕਰੇਲੇ ਇਹ ਸਬਜ਼ੀਆਂ ਆਪਣੇ ਘਰ ਦੇ ਬਗੀਚੇ ਵਿੱਚ ਅ ਉਗਾਈਆਂ ਹਨ ਨੈਚੁਰਲ ਤਰੀਕੇ ਦੇ ਨਾਲ਼ ਇਸ ਸਬਜ਼ੀਆਂ ਨੂੰ ਮੈਂ ਉਗਾਇਆ ਹੈ ਕਿਉਂਕਿ ਇਹ ਸਬਜ਼ੀਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਰਸਾਇਣਿਕ ਪਦਾਰਥ ਜਿਹੜਾ ਨਹੀਂ ਹੈ ਮੈਂ ਇਸਨੂੰ ਜਿਹੜੀ ਘਰ ਦੀ ਬਣਾਈ ਖਾਦ ਦੁਆਰਾ ਹੀ ਇਹਨਾਂ ਨੂੰ ਉਗਾਇਆ ਹੈ ਇਸ ਦੇ ਵਿੱਚ ਮੈਂ ਸਮੇਂ ਤੋਂ ਸਮੇਂ ਸਿਰ ਪਾਣੀ ਦਿੱਤਾ ਹੈ ਇਹਨਾਂ ਨੂੰ ਅਤੇ ਨੈਚੁਰਲ ਜਿਹੜੀ ਇੱਕ ਹੁੰਦੀ ਹੈ ਜਿਵੇਂ ਕਿ ਸਾਡੀ ਜਿਹੜੀ ਚਾਹ ਪੱਤੀ ਦੀ ਜੋ ਵੇਸਟ ਹੁੰਦਾ ਹੈ ਉਸਦੇ ਨਾਲ਼ ਇਹਨਾਂ ਨੂੰ ਉਗਾਇਆ ਹੈ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਹੈ ਜਿਹੜਾ ਨਹੀਂ ਹੈ ਮੈਨੂੰ ਇਸ ਇਸ ਵਾਲ਼ੀਆਂ ਸਬਜ਼ੀਆਂ ਖਾ ਕੇ ਖੁਦ ਨੂੰ ਹੀ ਬਹੁਤ ਹੀ ਜ਼ਿਆਦਾ ਅੱਛਾ ਮਹਿਸੂਸ ਹੁੰਦਾ ਹੈ ਮੈਨੂੰ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਜਿਹੜਾ ਇਹ ਹਰੀਆਂ ਸਬਜ਼ੀਆਂ ਹੋਗੀਆਂ ਫਲ ਫਰੂਟ ਹੋ ਗਏ ਬਿਨਾਂ ਰਸਾਇਣਾਂ ਤੋਂ ਖਾਣੇ ਚਾਹੀਦੇ ਹਨ ਕਿਉਂਕਿ ਇਸਦੇ ਨਾਲ਼ ਸਾਡੀ ਜਿਹੜੀ ਹੈ ਹੈਲਥ ਹੈ ਉਹ ਬਹੁਤ ਵਧੀਆ ਰਹਿੰਦੀ ਹੈ ਸਾਨੂੰ ਬਿਮਾਰੀਆਂ ਵੀ ਬਹੁਤ ਘੱਟ ਲੱਗਦੀਆਂ ਹਨ ਅਤੇ ਸਾਡਾ ਜਿਹੜਾ ਵਾਤਾਵਰਨ ਹੈ ਉਹ ਹਰਿਆ ਭਰਿਆ ਰਹਿੰਦਾ ਹੈ ਇਸ ਦੇ ਨਾਲ਼ ਸਾਨੂੰ ਜਿਹੜੀ ਸ਼ੁੱਧ ਹਵਾ ਹੈ ਉਹ ਮੈਂ ਮੈਂ ਮਿਲਦੀ ਹੈ ਸ਼ੁੱਧ ਹਵਾ ਮਿਲਣ ਦੇ ਨਾਲ਼ ਜੋ ਸਾਡੇ ਹੈਲਥ ਅਤੇ ਸਰੀਰ ਦੀ ਜੋ ਵਿਕਾਸ ਹੈ ਉਹ ਵਧੀਆ ਤਰੀਕੇ ਨਾਲ਼ ਹੁੰਦਾ ਹੈ